ਹੈਲੋ ਸਰ ਸਤਿ ਸ਼੍ਰੀ ਅਕਾਲ ਮੈਂ ਨਾ ਫੇਸ ਕਰੀਮ ਲਿੱਤੀ ਸੀ ਐਪ ਤੋਂ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਮੇਰਾ ਉਸ ਕਰੀਮ ਦੇ ਨਾਲ ਕਰੀਮ ਇੰਨੀ ਜ਼ਿਆਦਾ ਬੈਸਟ ਨਿਕਲੀ ਬਹੁਤ ਹੀ ਜ਼ਿਆਦਾ ਬੈਸਟ ਪਹਿਲਾਂ ਤਾਂ ਜੀ ਜਦੋਂ ਮੈਂ ਲਿੱਤੀ ਰਿਸੀਵ ਕੀਤੀ ਉਹਦੀ ਪੈਕਿੰਗ ਪੈਕਿੰਗ ਬੜੀ ਵਧੀਆ ਸੀ ਅਤੇ ਜਦੋਂ ਮੈਂ ਉਹਨੂੰ ਓਪਨ ਕੀਤੀ ਮੈਂ ਇੰਨੀ ਜ਼ਿਆਦਾ ਖੁਸ਼ ਹੋਈ ਮੀਨਜ਼ ਇੰਨੀ ਵਧੀਆ ਮੈਨੂੰ ਮੀਨਜ਼ ਉਹਦੀ ਪੈਕਿੰਗ ਲੱਗੀ ਦੈਨ ਜਦੋਂ ਮੈਂ ਓਪਨ ਉਹਨੂੰ ਕੀਤਾ ਤਾਂ ਬੜੀ ਸੋਹਣੀ ਡੱਬੀ ਵਿੱਚ ਆਈ ਗਲਾਸ ਜਿਵੇਂ ਕਹਿ ਸਕਦੇ ਨਾ ਆਪਾਂ ਕੱਚ ਦੇ ਗਲਾਸ ਵਰਗੀ ਸੀ ਉਹ ਪੂਰੀ ਡੱਬੀ ਬਹੁਤ ਹੀ ਸੋਹਣੀ ਡੱਬੀ ਸੀ ਫਿਰ ਜਦੋਂ ਮੈਂ ਉਹਨੂੰ ਓਪਨ ਕੀਤਾ ਕਰੀਮ ਨੂੰ ਦੈਨ ਜਦੋ ਮੈਂ ਕਰੀਮ ਦੇਖੀ ਇੰਨੀ ਲਾਈਟ ਲਾਈਟ ਮੋਇਸਚਰਾਈਜ਼ਰ ਕਰੀਮ ਵਾਂਗੂ ਲੱਗੀ ਸਿੰਪਲ ਲਾਇਟ ਕਰੀਮ ਮੀਨਜ਼ ਸਕਿੰਨ ਨੂੰ ਜਿਹੜੀ ਈਜ਼ੀਲੀ ਓਬਜਰਵ ਹੋ ਜਾਂਦੀ ਨਾ ਉਹੋ ਜਿਹੀ ਕਰੀਮ ਸੀ ਬੜੀ ਵਧੀਆ ਦੈਨ ਓਪਨ ਕੀਤੀ ਜਦੋਂ ਮੈਂ ਕਰੀਮ ਲਿੱਤੀ ਲਾਈਟ ਲੱਗੇ ਉਹਦਾ ਮੀਨਜ਼ ਫੇਸ ਜਿਵੇਂ ਨਾ ਭਾਰੀ ਭਾਰੀ ਹੈਵੀ ਹੈਵੀ ਉਹ ਜਿਹਾ ਵੀ ਫੀਲ ਹੋ ਹੀ ਨਹੀਂ ਸੀ ਰਿਹਾ ਐਨ ਲਾਈਟ ਲੱਗ ਰਹੀ ਸੀ ਫਿਰ ਉਹ ਕਰੀਮ ਜਦੋਂ ਮੈਂ ਯੂਜ ਕਰਨੀ ਸਟਾਰਟ ਕੀਤੀ ਫਸਟ ਡੇ ਤਾਂ ਪਹਿਲਾਂ ਤਾਂ ਐਕਸਪੀਰੀਅਸ ਸੀ ਬੜਾ ਵਧੀਆ ਰਿਹਾ ਐਹ ਪੂਰੀ ਸਕਿੰਨ 'ਤੇ ਅਬਜ਼ੋਬ ਹੋ ਗਈ ਅਤੇ ਅਬਜ਼ੋਬ ਅਤੇ ਇੱਕ ਨਾ ਅਲੱਗ ਜਿਹਾ ਗਲੋਅ ਦਿਖ ਰਿਹਾ ਸੀ ਫੇਸ ਦੇ ਉੱਪਰ ਜਦੋਂ ਲਗਾਉਣ ਤੋਂ ਬਾਅਦ ਫਿਰ ਮੈਂ ਦੇਖਿਆ ਕਿ ਜਿਹੜੇ ਮੇਰੇ ਮੈਂ ਡੇ ਬਾਏ ਡੇ ਜਦੋਂ ਮੈਂ ਕਰੀਮ ਯੂਜ ਕਰੀ ਗਈ ਮੇਰੇ ਜਿਹੜੇ ਐਕਨੇ ਸੀ ਉਹ ਸਾਰੇ ਹੀ ਰਿਮੂਵ ਹੋਣੇ ਸ਼ੁਰੂ ਹੋ ਗਏ ਐਕਨੇ ਮੇਰੇ ਵਾਈਟ ਹੈਡਸ ਬਲੈਕ ਹੈਡਸ ਸਕਿੰਨ ਪੂਰੀ ਗਲਾਸ ਵਰਗੀ ਹੋਣੀ ਸ਼ੁਰੂ ਹੋ ਗਈ ਮੀਨਜ ਇੰਨੀ ਜ਼ਿਆਦਾ ਈਵੰਨ ਟੋਨ ਵਾਈਟਨੈਂਸ ਆਉਣੀ ਸ਼ੁਰੂ ਹੋ ਗਈ ਬਹੁਤ ਹੀ ਵਧੀਆ ਕਰੀਮ ਸੀ ਦੈਨ ਮੈਂ ਸ਼ੁਰੂ ਕੀਤੀ ਮੇਰਾ ਸਕਿੰਨ ਬਹੁਤ ਵਧੀਆ ਅੱਗੇ ਨਾਲੋਂ ਇੰਨੀ ਜ਼ਿਆਦਾ ਸੋਫਟ ਹੋਈ ਸ ਜਿਹੜੀ ਆ ਮੇਰੀ ਸਕਿੰਨ ਫਿਰ ਮੈਂ ਰੈਕਮੈਂਡ ਕੀਤਾ ਆਪਣੀ ਮਦਰ ਨੂੰ ਕੇ ਤੁਸੀਂ ਵੀ ਇਹ ਹੀ ਯੂਜ ਕਰੋ ਕਰੀਮ ਉਹਨਾਂ ਦਾ ਵੀ ਇਹ ਹੀ ਐਕਸਪੀਰੀਅੰਸ ਸੀ ਸੇਮ ਹੀ ਸੀ ਕਿ ਹਾਂ ਵੀ ਮੀਨਜ਼ ਜਿਹੜੀ ਕਰੀਮ ਉਹ ਬਹੁਤ ਜ਼ਿਆਦਾ ਹੀ ਵਧੀਆ ਇੱਕ ਉਹਦੀ ਫਰੈਗਰੰਸ ਜਿਹੜੀ ਹੈਗੀ ਆ ਉਹ ਬਹੁਤ ਵਧੀਆ ਹੈਗੀ ਆ ਪੂਰੇ ਡੇ ਲਗਾ ਕੇ ਰੱਖੋ ਤਾਂ ਐਨ ਪੂਰਾ ਫਰੈਸ਼ ਲੁੱਕ ਦਿੰਦੀ ਹੈਗੀ ਆ ਮੀਨਜ਼ ਇਹ ਨਹੀਂ ਕਿ ਆਪ ਜਲਦੀ ਹੀ ਉਹਨੇ ਆਪਣਾ ਜਿਹੜਾ ਹੈਗਾ ਵਾ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈਗੀ ਆ ਟੈਨਿੰਗ ਨਹੀਂ ਹੋਣ ਦਿੰਦੀ ਅਤੇ ਇੱਕ ਨਾ ਹੀ ਓਇਲੀ ਓਇਲੀ ਵਰਗੀ ਲੱਗਦੀ ਹੈਗੀ ਆ ਬੜੀ ਵਧੀਆ ਕਰੀਮ ਆ ਮੀਨਜ਼ ਓਇਲੀ ਵਰਗੀ ਵੀ ਨਹੀਂ ਲੱਗਦੀ ਇਹ ਸਕਿੰਨ ਬੜੀ ਵਧੀਆ ਗਲੋਇੰਗ ਸਾਰਾ ਦਿਨ ਗਲੋਇੰਗ ਗਲੋਇੰਗ ਵਧੀਆ ਲੱਗਦਾ ਹੈਗਾ ਵਾ ਮੈਂ ਆਪਣੀ ਫਰੈਂਡਸ ਨੂੰ ਰੈਕਮੈਂਡ ਕੀਤੀ ਕਿ ਤੁਸੀਂ ਇਹ ਵਾਲੀ ਕਰੀਮ ਹੀ ਯੂਜ ਕਰੋ ਉਹਨਾਂ ਦੇ ਵੀ ਸੇਮ ਰੀਵਿਊ ਸੀ ਕਰੀਮ ਬਹੁਤ ਹੀ ਬੈਸਟ ਆ ਫਸਟ ਇੰਨੀ ਜ਼ਿਆਦਾ ਬੈਸਟ ਹੈਗੀ ਆ ਸੈਕਿੰਡ ਇਹਦਾ ਜਿਹੜਾ ਪ੍ਰਾਈਜ ਹੈਗਾ ਵਾ ਉਹ ਵੀ ਅਫੋਰਡਬਲ ਹੈਗਾ ਵਾ ਪ੍ਰਾਈਜ ਦੀ ਵੀ ਗੱਲ ਕਰੀਏ ਤਾਂ ਬਹੁਤ ਵਧੀਆ ਪ੍ਰਾਈਸ ਹੈਗਾ ਅਫੋਰਡਬਲ ਹੈਗਾ ਵਾ ਨਾ ਹੀ ਜ਼ਿਆਦਾ ਆਪਾਂ ਕਹਿ ਸਕਦੇ ਐਕਸਪੈਂਸਿਵ ਹੈਗਾ ਕਿ ਕੋਈ ਖਰੀਦ ਨਹੀਂ ਸਕਦਾ ਕਰੀਮ ਦੀਆਂ ਅਡਵਾਂਟੇਜਸ ਬਹੁਤ ਜ਼ਿਆਦਾ ਹੈਗੀਆਂ ਵਾ ਐਕਨੇ ਦੂਰ ਕਰ ਦਿੰਦੀ ਆ ਪਿੰਪਲਸ ਨਹੀਂ ਹੋਣ ਦਿੰਦੀ ਇੱਕ ਬਰਾਈਟ ਲੁੱਕ ਦੇ ਦਿੰਦੀ ਹੈਗੀ ਆ ਸੰਨਸਕ੍ਰੀਮ ਵਾਂਗੂ ਕੰਮ ਕਰਦੀ ਹੈਗੀ ਟੈਨਿੰਗ ਨਹੀਂ ਹੋਣ ਦਿੰਦੀ ਟਵੈਲਵ ਅਵਰਸ ਤੱਕ ਤੁਹਾਡੇ ਸਕਿ ਜਿਹੜੀ ਸਕਿੰਨ ਹੈਗੀ ਉਹ ਬਰਾਈਟ ਰਹਿੰਦੀ ਹੈਗੀ ਆ ਅਤੇ ਤੁਹਾਡੇ ਸਾਰੀ ਸਕਿੰਨ ਜਿਹੜੀ ਹੈਗੀ ਆ ਉਹ ਪੂਰੀ ਤਰਾਂ ਹੀ ਗਲੋਇੰਗ ਕਰਨੀ ਸ਼ੁਰੂ ਕਰ ਦਿੰਦੀ ਹੈਗੀ ਆ ਬੈਸਟ ਕਰੀਮ ਹੈਗੀ ਫੇਸ ਕਰੀਮ ਜਿਹੜੀ ਮੈਂ ਇਸ ਇਸ ਐਪ ਤੋਂ ਮੰਗਵਾਈ ਹੈਗੀ ਆ ਪੈਕਿੰਗ ਤੋਂ ਲੈ ਕੇ ਯੂਜ ਤੋਂ ਲੈ ਕੇ ਮੀਨਸ ਹਰ ਇੱਕ ਚੀਜ਼ ਉਹਦੀ ਬੈਸਟ ਹੈਗੀ ਆ ਪ੍ਰਾਈਜ ਆਪਾਂ ਕਹਿ ਸਕਦੇ ਆ ਕਿ ਹਰ ਇੱਕ ਚੀਜ਼ ਉਹਦੀ ਬੈਸਟ ਆ ਕੋਈ ਇਹਦਾ ਡਿਸਐਡਵਾਟੇਂਜ ਨਹੀਂ ਹੈਗਾ ਹਾਂ ਵੀ ਹਰ ਇੱਕ ਸਕਿੰਨ ਟੋਨ ਵਾਸਤੇ ਕਰੀਮ ਜਿਹੜੀ ਬੈਸਟ ਵਾ ਹਰ ਇੱਕ ਸਕਿੰਨ ਟੋਨ ਵਾਸਤੇ ਬਹੁਤ ਹੀ ਵਧੀਆ ਸਕਿੰਨ ਵਾਸਤੇ ਜਿਹੜੀ ਟੋਨ ਵਾਸਤੇ ਜਿਹੜੀ ਹੈਗੀ ਆ ਕਰੀਮ ਬੈਸਟ ਹੈਗੀ ਆ ਇਹ ਵਾਲੀ ਦੈਨ ਮੈਂ ਸਭ ਨੂੰ ਰੈਕਮੈਂਡ ਕਰੂੰਗੀ ਕਿ ਇਹ ਵਾਲੀ ਫੇਸ ਕਰੀਮ ਯੂਜ ਕਰਕੇ ਦੇਖਣ ਅਤੇ ਤਾਂ ਜੋ ਹਰ ਕੋਈ ਜਿਹੜੀ ਕਿ ਆਪਣੀ ਸਕਿੰਨ ਜਿਹੜੀ ਹੈਗੀ ਆ ਉਹ ਕਲੀਅਰ ਕਰੇ ਕੋਈ ਐਕਨੇ ਦੇ ਨਿਸ਼ਾਨ ਨਾ ਰਹੇ ਸਭ ਤੋਂ ਬੈਸਟ ਕਰੀਮ ਆ